ਐਰੋਬਿਕਸ ਕਸਰਤ ਹੈ ਇਕ ਸੰਗੀਤ ਉੱਤੇ ਅਧਾਰਤ ਕਸਰਤ ਹੈ ਜਿਹੜੀ ਕਿ ਸਾਨੂੰ ਪੱਛਮੀ ਸੱਭਿਅਤਾ ਦੀ ਦੇਣ ਤਾਂ ਜ਼ਰੂਰ ਹੈ ਪਰ ਇਸ ਵਿੱਚ ਜਿਹੜਾ ਹੈ ਆਪਣਾ ਤਨ ਮਨ ਤੰਦਰੁਸਤ ਚੁਸਤ ਰਹਿੰਦਾ ਸਰੀਰ ਨੂੰ ਅ ਤਣਾਅ ਤੋਂ ਦੂਰ ਰੱਖਦਾ ਅੱਜ ਕੱਲ੍ਹ ਜਿਵੇਂ ਹੁਣ ਨੌਜਵਾਨ ਵਰਗ ਨੇ ਐਰੋਬਿਕਸ ਨੂੰ ਅਪਣਾਉਂਦੇ ਨੇ ਉਹ ਆ ਉਹਨਾਂ ਨਾਲ ਮਹੱਤਵ ਹੋਰ ਵੀ ਵੱਧ ਜਾਂਦਾ ਐਰੋਬਿਕਸ ਕਸ ਕਸਰਤਾਂ ਨੇ ਹੁਣ ਭਾਰਤ ਵਿੱਚ ਆਪਣੀਆਂ ਜੜ੍ਹਾਂ ਕਾਫੀ ਬਣਾ ਲਈਆਂ ਨੇ ਜਿਵੇਂ ਹੁਣ ਅੱਸੀ ਉੱਨੀ ਸੌ ਅੱਸੀ ਦੇ ਬਾਅਦ ਭਾਰਤ ਦੇ ਮਹਾਂਨਗਰਾਂ ਦੇ ਨਾਲ ਨਾਲ ਲਗਭਗ ਸਾਰੇ ਸ਼ਹਿਰਾਂ ਵਿੱਚ ਹੀ ਜਿੰਮ ਕੇਂਦਰ ਖੁੱਲ੍ਹ ਗਏ ਸੀ ਅਤੇ ਇਹ ਸੱਭਿਆਚਾਰ ਵਿਰਸੇ ਨੂੰ ਪੰਜਾਬੀ ਸੱਭਿਆਚਾਰਕ ਦੇ ਵਿਰਸੇ ਨੂੰ ਇਹ ਇਸ ਤਰ੍ਹਾਂ ਦਰਸਾਉਂਦੇ